ਵੈਸੇ ਤਾਂ ਮੈਨੂੰ ਬਹੁਤ ਸਾਰੇ ਕਲਾਕਾਰ ਪਸੰਦ ਹਨ ਪਰ ਮੇਰੇ ਪਿਤਾ ਜੀ ਦਾ ਕੰਮ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਉਹ ਵੀ ਇੱਕ ਕਲਾਕਾਰ ਹਨ ਅਤੇ ਉਹਨਾਂ ਤੋਂ ਹੀ ਪ੍ਰੇਰਨਾ ਲੈ ਕੇ ਮੈਂ ਬਚਪਨ ਤੋਂ ਡਰਾਇੰਗ ਦਾ ਕੰਮ ਸਿੱਖਿਆ ਅਤੇ ਹੌਲ਼ੀ ਹੌਲ਼ੀ ਮੇਰੇ ਹੱਥ ਵਿੱਚ ਸੁਧਾਰ ਆਉਂਦਾ ਗਿਆ ਮੈਂ ਬਚਪਨ ਵਿੱਚ ਉਹਨਾਂ ਨੂੰ ਸ ਡਰਾਇੰਗ ਕਰਦਿਆਂ ਨੂੰ ਵੇਖਦੀ ਹੁੰਦੀ ਸੀ ਅਤੇ ਮੈਨੂੰ ਵੀ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰੇਰਨਾ ਮਿਲੀ ਅਤੇ ਮੈਂ ਵੀ ਉਹ ਕੰਮ ਕਰਨਾ ਸ਼ੁਰੂ ਕੀਤਾ ਅਤੇ ਹੌਲ਼ੀ ਹੌਲ਼ੀ ਮੈਂ ਕਾਰਟੂਨ ਬਣਾਉਣੇ ਸ਼ੁਰੂ ਕੀਤੇ ਅਤੇ ਮੈਂ ਡਰਾਇੰਗ ਕਰਨੀ ਸ਼ੁਰੂ ਕੀਤੀ ਉਸ ਤੋਂ ਬਾਅਦ ਫਿਰ ਮੈਂ ਵੱਡੇ ਵੱਡੇ ਆਰਟਿਸਟਾਂ ਦੇ ਸਕੈੱਚ ਬਣਾਉਣੇ ਸ਼ੁਰੂ ਕੀਤੇ ਜਿਹਨਾਂ ਵਿੱਚ ਕਿ ਰਾਹਤ ਫਤਿਹ ਅਲੀ ਖਾਨ ਜੋ ਕਿ ਇੱਕ ਮਸ਼ਹੂਰ ਸਿੰਗਰ ਹਨ ਅਤੇ ਉਰਵਸ਼ੀ ਰੋਟੇਲਾ ਦਾ ਸਕੈੱਚ ਬਣਾਇਆ ਜੋ ਕਿ ਇੱਕ ਬੋਲੀਵੁੱਡ ਦੀ ਹੀਰੋਇਨ ਹੈ ਅਤੇ ਉਸ ਤੋਂ ਬਾਅਦ ਮੈਂ ਬਹੁਤ ਸਾਰੇ ਬਣਾਏ ਜਿਵੇਂ ਕਿ ਸ਼ਾਹਰੁਖ ਖਾਨ ਉਹ ਵੀ ਇੱਕ ਬੋਲੀਵੁੱਡ ਦਾ ਹੀਰੋ ਹੈ ਅਤੇ ਐਵੇਂ ਹੀ ਮੇਰੇ ਹੱਥ ਵਿੱਚ ਬਹੁਤ ਜ਼ਿਆਦਾ ਸੁਧਾਰ ਆਉਂਦਾ ਗਿਆ ਅਤੇ ਮੈਂ ਅੱਗੇ ਅੱਗੇ ਬਣਾਉਂਦੀ ਗਈ ਅਤੇ ਹੁਣ ਬਹੁਤ ਜ਼ਿਆਦਾ ਸਕੈੱਚ ਬਣਾਏ ਅਤੇ ਲੋਕਾਂ ਦੇ ਬਣਾਏ ਲਾਈਵ ਸਕੈਚਿੰਗ ਕਰਦੀ ਹਾਂ ਅਤੇ ਕਈਆਂ ਕਈ ਮੇਰੇ ਕੋਲ ਸਕੈੱਚ ਬਣਵਾਉਣ ਆਉਂਦੇ ਹਨ ਅਤੇ ਕਈਆਂ ਨੂੰ ਮੈਂ ਖੁਦ ਆਪਣੇ ਹੱਥ ਨਾਲ ਬਣਾ ਕੇ ਵੀ ਦੇ ਕੇ ਆਈ ਹਾਂ